ਮਸ਼ੀਨ ਜਦੋਂ ਧਾਗਾ ਤੋੜਨ ਲੱਗ ਜਾਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਮਸ਼ੀਨ ਦਾ ਕੋਈ ਅੰਦਰੂਨੀ ਜਾਂ ਬਾਹਰੀ ਪੁਰਜ਼ਾ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ ਅਤੇ ਇਹ ਹੋਣ 'ਤੇ ਸਾਨੂੰ ਮਸ਼ੀਨ ਦੇ ਸਾਰੇ ਪੁਰਜ਼ਿਆਂ ਨੂੰ ਇੱਕ ਇੱਕ ਕਰਕੇ ਚੈੱਕ ਕਰਨਾ ਚਾਹੀਦਾ ਹੈ ਅਤੇ ਪੁਰਜ਼ਿਆਂ ਨੂੰ ਥੋੜ੍ਹਾ ਸਾਫ ਕਰਕੇ ਅਤੇ ਦੁਬਾਰਾ ਉਹਨਾਂ ਨੂੰ ਸੈਟ ਕਰਕੇ ਲਾਉਣ 'ਤੇ ਮਸ਼ੀਨ ਚਲਾਵਾਂਗੇ ਅਤੇ ਉਸ ਤੋਂ ਬਾਅਦ ਮਸ਼ੀਨ ਧਾਗਾ ਨਹੀਂ ਤੋੜੇਗੀ